ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਫ਼ਸਲਾਂ ਜਿਹੜੀਆਂ ਵਾ ਉਹ ਪਸੰਦ ਨੇ ਕਿਉਂਕਿ ਜਦੋਂ ਖੇਤੀ ਕਰਦੇ ਨੇ ਤਾਂ ਉਹਨਾਂ ਨੂੰ ਹੁੰਦਾ ਕਿ ਸਾਡੀਆਂ ਫ਼ਸਲਾਂ ਵਧੀਆ ਵਧੀਆ ਗਰੋ ਕਰਨ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਪੈਸੇ ਜਿਹੜੇ ਆ ਉਹ ਕਿਸਾਨਾਂ ਨੂੰ ਮਿਲਣ ਜਿਵੇਂ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਪੰਪਕਿਨ ਕੱਦੂ ਐਪਲ ਜਾਂ ਨਾਕ ਕੱਦੂ ਜਿਹੜਾ ਆ ਉਹ ਉਹਦੀ ਫ਼ਸਲ ਜਿਹੜੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਕੱਦੂ ਦੀ ਸਬਜ਼ੀ ਹਰੀ ਸਬਜ਼ੀ ਹੁੰਦੀ ਆ ਉਹਦੇ ਬਹੁਤ ਸਾਰੇ ਫਾਇਦੇ ਨੇ ਇਸ ਕਰਕੇ ਸਾਰੇ ਘਰਾਂ ਦੇ ਵਿੱਚ ਕੱਦੂ ਜਿਹੜੇ ਆ ਉਹ ਮਨਪਸੰਦ ਇੱਕ ਤਰ੍ਹਾਂ ਦੀ ਗਰਮੀ ਦੀ ਸਬਜ਼ੀ ਹੈ ਸੋ ਕਿਸਾਨ ਜਦੋਂ ਕੱਦੂ ਲਾਉਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਲਈ ਇਹਨਾਂ ਨੂੰ ਬੜੇ ਤਰੀਕੇ ਨਾਲ ਕੱਦੂ ਲਾਉਣੇ ਪੈਂਦੇ ਨੇ ਤਾਂ ਕਿ ਉਹਨਾਂ ਨੂੰ ਕੋਈ ਤਰ੍ਹਾਂ ਕਿ ਕੋਈ ਜਾਨਵਰ ਉਹਨਾਂ ਨੂੰ ਖ਼ਰਾਬ ਨਾ ਕਰ ਸਕੇ ਉਹਦੀ ਫ਼ਸਲ ਕਰਦੇ ਨੇ ਅਤੇ ਉਹ ਗਰਮੀਆਂ ਦਾ ਸਬਜ਼ੀ ਹੋਣ ਕਰਕੇ ਗਰਮੀਆਂ ਦੀ ਸਬਜ਼ੀ ਹੋਣ ਕਰਕੇ ਇਹਨੂੰ ਲੋਕ ਪਸੰਦ ਵੀ ਬਹੁਤ ਕਰਦੇ ਨੇ ਸੋ ਕੱਦੂ ਜਿਹੜਾ ਆ ਉਹ ਸਿਹਤ ਲਈ ਜਿਵੇਂ ਡਾਕਟਰਾਂ ਨੇ ਕਿਹਾ ਆ ਕਿ ਸਿਹਤ ਸਿਹਤ ਬਣਾਉਣ ਲਈ ਕੱਦੂ ਬਹੁਤ ਜ਼ਰੂਰੀ ਹੈ ਇਸ ਕਰਕੇ ਉਹ ਇਹਦੀ ਫ਼ਸਲ ਜਿਹੜੀ ਆ ਉਹ ਜ਼ਿਆਦਾ ਪ੍ਰਾਪਤ ਕਰਦੇ ਆ ਅਤੇ ਉਹਨਾਂ ਨੂੰ ਜਾ ਕੇ ਮੰਡੀ ਵਿੱਚ ਵੇਚ ਦਿੰਦੇ ਨੇ ਸੇਬ ਅਤੇ ਨਾਖ ਜਿਹੜੀ ਇਹਨਾਂ ਦੇ ਬਾਗ ਲਾਏ ਜਾਂਦੇ ਹਨ ਕਿਉਂਕਿ ਇਹ ਵੀ ਫਰੂਟ ਜਿਹੜਾ ਵਾ ਉਹ ਲੋਕੀਂ ਖੁਸ਼ ਹੋ ਕੇ ਖਾਂਦੇ ਹਨ ਐਪਲ ਜੋ ਬਹੁਤ ਮਹਿੰਗਾ ਸੇਬ ਜਿਹੜਾ ਮਾਰਕੀਟ ਵਿੱਚ ਵਿਕਦਾ ਹੈ ਉਹਦੀ ਵੀ ਇਹ ਫ਼ਸਲ ਪ੍ਰਾਪਤ ਕਰਦੇ ਹਨ ਨਾਖਾਂ ਜਿਹੜੀਆਂ ਨੇ ਉਹ ਵੀ ਗਰਮੀਆਂ ਦੇ ਵਿੱਚ ਲੋਕੀਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਹੁਤ ਸਾਰੇ ਇਹਦੇ ਵਿੱਚ ਵਿਟਾਮਿਨ ਮਿਲਦੇ ਨੇ ਉਹਨਾਂ ਨੂੰ ਇਸ ਕਰਕੇ ਜਿਹੜੇ ਕਿਸਾਨ ਆ ਜ਼ਿਆਦਾਤਰ ਇਹ ਫ਼ਸਲਾਂ ਜਿਹੜੀਆਂ ਮੁੱਖ ਇਹਨਾਂ ਤੋਂ ਪ੍ਰਾਪਤ ਕਰਦੇ ਨੇ ਪੈਸਾ ਅਤੇ ਲੋਕੀਂ ਵੀ ਖੁਸ਼ ਹੁੰਦੇ ਨੇ ਅਤੇ ਆਪਣਾ ਸਿਹਤਮੰਦ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ ਧੰਨਵਾਦ